ਸਾਡੇ ਰਾਜ ਵਿੱਚ ਬਹੁਤ ਸਾਰੇ ਆਗੂ ਗੁਰੂ ਹਨ ਜਿਹਨਾਂ ਤੋਂ ਅਸੀਂ ਸੱਚ ਬੋਲਣਾ ਸੱਚ ਦੇ ਲਈ ਖੜ੍ਹਨਾ ਹੱਕ ਸੱਚ ਲਈ ਲੜਨਾ ਅਤੇ ਬੇਸਹਾਰਿਆਂ ਦੀ ਮੱਦਦ ਕਰਨਾ ਇਹ ਸਿੱਖਦੇ ਹਾਂ